ਪੰਜਾਬ ਵਿੱਚ ਬਹੁਤ ਪ੍ਰਮੁੱਖ ਕਲਾ ਭਾਈਚਾਰੇ ਜਾਂ ਸੰਸਥਾਵਾਂ ਜਿਹਨਾਂ ਨੂੰ ਸਥਾਨਕ ਕਲਾਕਾਰਾਂ ਦਾ ਸਮਰਥਨ ਦਿੱਤਾ ਜਾਂਦਾ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਮਰ ਕੈਂਪ ਗਰਮੀਆਂ ਦੇ ਵਿੱਚ ਜਿਵੇਂ ਲਗਾਏ ਜਾਂਦੇ ਹਨ ਉਹਦੇ ਵਿੱਚ ਬੱਚਿਆਂ ਨੂੰ ਗੱਤਕਾ ਸਿਖਲਾਈ ਦਸਤਾਰ ਬੰਨਣੀ ਡਰਾਇੰਗ ਮੁਕਾਬਲੇ ਪੋਸਟਰ ਮੁਕਾਬਲੇ ਸੁੰਦਰ ਲਿਖਾਈ ਮੁਕਾਬਲੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਕਿ ਗੱਤਕਾ ਗੱਤਕੇ ਦੇ ਵਿੱਚ ਆਪ ਦੀ ਹਿਫਾਜਤ ਵਾਸਤੇ ਗੱਤਕਾ ਸਿਖਾਇਆ ਜਾਂਦਾ ਅਤੇ ਦੂਜਾ ਕਰਾਟੇ ਸਿਖਾਏ ਜਾਂਦੇ ਹਨ ਕਰਾਟਿਆਂ ਵਿੱਚ ਵੀ ਆਪਦੀ ਹਿਫਾਜਤ ਵਾਸਤੇ ਮਤਲਬ ਕਿ ਕੋਈ ਤੀਸਰਾ ਬੰਦਾ ਵਾਰ ਨਾ ਕਰੇ ਇਸ ਕਰਕੇ ਕਰਾਟੇ ਸਿਖਾਏ ਜਾਂਦੇ ਆ ਅਤੇ ਪੋਸਟਰ ਡਰਾਇੰਗ ਮੁਕਾਬਲੇ ਪੋਸਟਰ ਮੁਕਾਬਲੇ ਸੁੰਦਰ ਲਿਖਾਈ ਮੁਕਾਬਲੇ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਭਾਈ ਜਸਵਿੰਦਰ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਹੈ ਹਰੇਕ ਹ ਤੌਰ 'ਤੇ ਕਮਜ਼ੋਰ ਹੈ ਜਿਹਨਾਂ ਦਾ ਬੱਚਾ ਹਰੇਕ ਬੱਚਾ ਜੋ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ ਅਤੇ ਅੱਗੇ ਪੜ੍ਹਨਾ ਚਾਹੁੰਦਾ ਹੈ ਪਰ ਘਰ ਦੀ ਆਰਥਿਕ ਤੌਰ 'ਤੇ ਕਮਜ਼ੋਰ ਹੈ ਉਸ ਦੀ ਮਦਦ ਕਰਦੇ ਹਨ ਅਤੇ ਇਸ ਕਰਕੇ ਕਿ ਉਹ ਬੱਚੇ ਅੱਗੇ ਵੱਧ ਸਕਣ ਅਤੇ ਇਸ ਨਾਲ ਹੋਰ ਵੀ ਕਲਾ ਭਵਨ ਚੰਡੀਗੜ੍ਹ ਵਿੱਚ ਅਤੇ ਪੰਜਾਬ ਸਾਲਾ ਅੰਮ੍ਰਿਤਸਰ ਵਿੱਚ ਹੈ